ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਆ ਬੱਚੇ ਕਿੱਦਾਂ ਹਾਂਜੀ ਬਸ ਠੀਕ ਠਾਕ ਹਾਂਜੀ ਹਾਂਜੀ ਠੀਕ ਠਾਕ ਸਭ ਵਧੀਆ ਚੱਲੀ ਜਾਂਦਾ ਹਾਂਜੀ ਮੈਂ ਹੁਣ ਘਰੋਂ ਕਰਵਾਉਣੀ ਚਾਹੀਦੀ ਹੈ ਹੁਣ ਤਾਂ ਹਾਂਜੀ ਹਾਂਜੀ ਮੈਂ ਵੀ ਸੋਚ ਰਹੀ ਸੀਗੀ ਪਰ ਮੇਰੇ ਹਾਲੇ ਮਾਈਂਡ ਦੇ ਵਿੱਚ ਦਿਮਾਗ 'ਚ ਆ ਨਹੀਂ ਰਿਹਾ ਕਿ ਆਪਣੇ ਏਰੀਏ ਦੇ ਵਿੱਚ ਸਕੂਲ ਵਧੀਆ ਹੋਵੇ ਕੋਈ ਹੈ ਨਾ ਅਤੇ ਮੈਂ ਇੱਦਾਂ ਸੋਚ ਰਹੀ ਸੀਗੀ ਕਿ ਪਹਿਲਾਂ ਸਕੂਲ ਦੇ ਬਾਰੇ ਆਪਾਂ ਜਾਣਕਾਰੀ ਇਕੱਠੀ ਕਰ ਲਈਏ ਕਿਹੜਾ ਸਕੂਲ ਸਾਡੇ ਇਸ ਇਲਾਕੇ ਦੇ ਵਿੱਚ ਵਧੀਆ ਹੈਗਾ ਆ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਤਾਂ ਚਾਹੁੰਦੀ ਹਾਂ ਕਿ ਮੈਂ ਆਪਣੇ ਬੱਚੇ ਨੂੰ ਇੱਦਾਂ ਦੇ ਸਕੂਲ 'ਚ ਪਾਵਾਂ ਜਿਹੜੇ ਚਲੋ ਆਹਾ ਅੱਜ ਕੱਲ੍ਹ ਨਾ ਆਹਾ ਇੱਕ ਰਿਵਾਜ਼ ਜਿਹਾ ਹੀ ਬਣ ਗਿਆ ਆ ਕਿ ਹਰ ਕੋਈ ਪੇਰੈਂਟ ਇਹੀ ਚਾਹੁੰਦਾ ਹਰ ਸਾਰੇ ਮਾਪੇ ਇਹੀ ਚਾਹੁੰਦੇ ਕਿ ਸਾਡਾ ਬੱਚਾ ਇੰਗਲਿਸ਼ ਮੀਡੀਅਮ ਮੀਡੀਅਮ ਪੜ੍ਹੇ ਅਤੇ ਵਧੀਆ ਚਲੋ ਇੰਗਲਿਸ਼ ਮੀਡੀਅਮ ਮੀਡੀਅਮ ਠੀਕ ਆ ਇੰਟਰਨੈਸ਼ਨਲ ਲੈਂਗੂਏਜ਼ ਉਹ ਸਾਨੂੰ ਸਿੱਖਣੀ ਚਾਹੀਦਾ ਆ ਆਪਣੀ ਜਿਹੜੀ ਭਾਸ਼ਾ ਹੈਗੀ ਪੰਜਾਬੀ ਸਾਡੀ ਮਾਂ ਬੋਲੀ ਆ ਉਹਦੇ ਨਾਲ ਵੀ ਥੋੜ੍ਹਾ ਬਹੁਤਾ ਜੋੜ ਕੇ ਰੱਖੇ ਉਹ ਸਕੂਲ ਹੈ ਨਾ ਜਿਹਦੇ ਵਿੱਚ ਜ਼ਿਆਦਾ ਪੰਜਾਬੀ ਨੂੰ ਵੀ ਥੋੜ੍ਹਾ ਜਿਹਾ ਬਰਾਬਰ ਦਾ ਦਰਜਾ ਦਵੇ ਉਹ ਸਕੂਲ 'ਚ ਮੈਂ ਪੜ੍ਹਾਉਣਾ ਚਾਹੁੰਦੀ ਹਾਂ ਆਪਣੇ ਬੱਚੇ ਨੂੰ ਅਤੇ ਹਾਂਜੀ ਸਾਡੇ ਤਾਂ ਹੈਗਾ ਵੈਸੇ ਸਾਡੇ ਨੇੜੇ ਹੀ ਆ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹੈ ਵਧੀਆ ਵੈਸੇ ਮੈਂ ਜਿੰਨਿਆਂ ਤੋਂ ਵੀ ਪੁੱਛਿਆ ਆ ਵੀ ਪੜ੍ਹਾਈ ਵਧੀਆ ਹੈਗੀ ਆ ਅਤੇ ਉਦਾਂ ਵੀ ਹੈ ਕਿ ਸਾਨੂੰ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਵੀ ਜੋੜਦੇ ਆ ਆਪਣੇ ਵਿਰਾਸਤ ਦੇ ਨਾਲ ਵੀ ਜੋੜਦੇ ਆ ਐਕਟੀਵਿਟੀਜ਼ ਵੀ ਇੱਦਾਂ ਦੀਆਂ ਕਰਵਾਈਆਂ ਜਾਂਦੀਆ ਆ ਅਲੱਗ ਹਾਂ ਹਾਂ ਗੁਰਬਾਣੀ ਵੀ ਕੀਰਤਨ ਵੀ ਸਿਖਾਉਂਦੇ ਆ ਉੱਥੇ ਅਤੇ ਵਧੀਆ ਮਤਲਬ ਹੈਗਾ ਆ ਜੋ ਮੈਂ ਸੁਣਿਆ ਆ ਬਾਕੀ ਦੇਖ ਲਵਾਂਗੇ ਅਸੀਂ ਇੱਕ ਵਾਰੀ ਉੱਥੇ ਜਾ ਕੇ ਵੀ ਕਿੱਦਾਂ ਹੈਗਾ ਅੱਛਾ ਜੀ ਹਾਂਜੀ ਅੱਛਾ ਹਾਂਜੀ ਹਾਂਜੀ ਹਨ ਅੱਛਾ ਜੀ ਹਾਂਜੀ ਐਵੇਂ ਹੀ ਬੱਚੇ ਨੂੰ ਪ੍ਰੋਬਲਮ ਵੀ ਹਾਂ ਹਾਂਜੀ ਕਰਵਾਉਂਦੇ ਹੈ ਐਕਟੀਵਿਟੀਜ਼ ਤਾਂ ਹੈਗੀਆਂ ਹੈ ਇੱਥੇ ਬਾਕੀ ਜਿਹੜੀਆਂ ਪੜ੍ਹਾਈ ਦੇ ਨਾਲ ਨਾਲ ਗੇਮਸ ਆ ਖੇਡਾਂ ਦੇ ਵਿੱਚ ਵੀ ਬੱਚਿਆਂ ਨੂੰ ਪੂਰਾ ਪਾਰਟੀਸਪੇਸ਼ਨ ਪੂਰੀ ਹਿੱਸੇਦਾਰੀ ਉਹਨਾਂ ਦੀ ਪਵਾਈ ਜਾਂਦੀ ਆ ਹਾਂਜੀ ਜਿਸ ਤਰ੍ਹਾਂ ਅਗਸਤ ਹੋ ਗਿਆ ਜਿੱਦਾਂ ਸਵਤੰਤਰਤਾ ਦਿਵਸ ਏ ਆ ਜਾਂ ਅਤੇ ਹਰ ਸਾਲ ਸਲਾਨਾ ਪ੍ਰੋਗਰਾਮ 'ਤੇ ਬੱਚਿਆਂ ਨੂੰ ਵਿਰਸੇ ਵਿਰਸੇ ਨਾਲ ਰਿਲੇਟਿਡ ਜਿੱਦਾਂ ਗਿੱਦਾ ਭੰਗੜਾ ਇੱਦਾਂ ਦੀਆਂ ਐਕਟੀਵਿਟੀਜ਼ ਦੇ ਨਾਲ ਵੀ ਜੋੜਿਆ ਜਾਂਦਾ ਬੱਚਿਆਂ ਨੂੰ ਗਿੱਧਾ ਭੰਗੜਾ ਵੀ ਸਿਖਾਉਂਦੇ ਆ ਹਾਂਜੀ ਅਤੇ ਹਾਂਜੀ ਅਤੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਨਹੀਂ ਇਹ ਸਕੂਲ ਦੀ ਵੈਸੇ ਜਿੱਥੇ ਤੱਕ ਮੈਂ ਸੁਣਿਆ ਆ ਕਿ ਇਸ ਸਕੂਲ ਦੀ ਫੀਸ ਵੀ ਇੰਨੀ ਜ਼ਿਆਦਾ ਨਹੀਂ ਹੈਗੀ ਜਿਹੜੇ ਨੋਰਮਲ ਇਨਕਮ ਵਾਲੇ ਨੋਰਮਲ ਆਮਦਨ ਵਾਲੇ ਪੇਰੈਂਟਸ ਆ ਉਹ ਵੀ ਮਾਪੇ ਜਿਹੜੇ ਪੜ੍ਹਾ ਸਕਦੇ ਬੱਚਿਆਂ ਨੂੰ ਹਾਂਜੀ ਕਰ ਸਕਦੇ ਆ ਇੰਨਾ ਖਰਚਾ ਨਹੀਂ ਹੈਗਾ ਕਿ ਬਸ ਇੱਕ ਫੀਸ ਜਿਹੜੀ ਸਲਾਨਾ ਫੀਸ ਲੈਂਦੇ ਉਸ ਤੋਂ ਬਾਅਦ ਜਿਹੜੀ ਆਪਣੀ ਮਹੀਨੇ ਮਹੀਨੇ ਬਾਅਦ ਫੀਸ ਏ ਆ ਉਹ ਵੀ ਕੋਈ ਇੰਨੀ ਜ਼ਿਆਦਾ ਨਹੀਂ ਹੈਗੀ ਨਾ ਮੀਨ ਹਾਂਜੀ ਹਾਂਜੀ ਹਾਂਜੀ ਉਹਦੇ ਕਰਕੇ ਵੀ ਹੁੰਦਾ ਆ ਬੱਸਾਂ ਦੀ ਵੀ ਫੀਸ ਇੰਨੀ ਜ਼ਿਆਦਾ ਤਾਂ ਨਹੀਂ ਹੈਗੀ ਮੇਰੇ ਹਿਸਾਬ ਨਾਲ ਤਾਂ ਜਿੱਥੇ ਤੱਕ ਮੈਂ ਸੁਣਿਆ ਆ ਖਰਚਾ ਤਾਂ ਇੰਨਾ ਨਹੀਂ ਹੈਗਾ ਸਕੂਲ ਦਾ ਬਾਕੀ ਆਪਾਂ ਹਾਂਜੀ ਦੇਖ ਲਵਾਂਗੇ ਹਾਂਜੀ ਹਾਂਜੀ ਚਲੋ ਫਿਰ ਆਪਾਂ ਇੱਦਾਂ ਕਰਦੇ ਆਪਾਂ ਹਾਂ ਇੱਕ ਦਿਨ ਆਪਾਂ ਜਾ ਕੇ ਦੇਖਦੇ ਹਾਂਜੀ ਪਤਾ ਕਰ ਲੈਂਦੇ ਹਾਂਜੀ ਹਾਂਜੀ ਅਸੀਂ ਜਿਸ ਦਿਨ ਕਰ ਲਵਾਂਗੇ ਇੱਕ ਵਾਰ ਹਾਂਜੀ ਹਾਂਜੀ ਓਕੇ ਜੀ